ਰੂਪਨਗਰ ਜ਼ਿਲ੍ਹੇ ਵਿੱਚ ਮੁੱਖ ਵਿੱਦਿਅਕ ਅਦਾਰੇ ਅਤੇ ਮੌਕੇ ਬਹੁਤ ਸਾਰੇ ਹਨ ਜਿਨ੍ਹਾਂ ਨਾਲ ਅਸੀਂ ਆਪਣਾ ਸਥਾਨ ਪ੍ਰਾਪਤ ਕਰ ਸਕਦੇ ਹਨ ਸਕੂਲਾਂ ਦੀਆਂ ਫ਼ੀਸਾਂ ਵੀ ਬਹੁਤ ਕਿਫਾਇਤੀ ਹਨ ਅਤੇ ਲੋਕ ਅੱਜ ਕੱਲ੍ਹ ਦੇ ਸਮੇਂ ਵਿੱਚ ਬੀ ਐੱਸ ਐਥੀਕਲ ਹੈ ਹੈਕਿੰਗ ਵਰਗੇ ਕੋਰਸਾਂ ਨੂੰ ਵੀ ਬਹੁਤ ਤਰਜ਼ੀਹ ਦਿੰਦੇ ਹਨ